ਔਰਤਾਂ ਨੂੰ ਰੋਜ਼ਾਨਾ ਦੇ ਆਧਾਰ 'ਤੇ ਬੜੀਆਂ ਚੁਣੌਤੀਆਂ ਨਾਲ ਸਾਹਮਣਾ ਕਰਨਾ ਪੈਂਦਾ ਹੈ ਔਰਤ ਨੂੰ ਦੇਖੋ ਜੀ ਸਵੇਰੇ ਜਲਦੀ ਉੱਠ ਕੇ ਆਪ ਤਿਆਰ ਹੋਣਾ ਜਾਂ ਬੱਚਿਆਂ ਨੂੰ ਤਿਆਰ ਕਰਕੇ ਫਿਰ ਉਹ ਬਸ ਫੜ ਕੇ ਟੈਕਸੀ ਫੜ ਕੇ ਪੈਦਲ ਚੱਲ ਕੇ ਫਿਰ ਆਪਣੇ ਜਿੱਥੇ ਉਹ ਕਿੱਤਾ ਕਰਦੀ ਹੈ ਜਿੱਥੇ ਉਹ ਕੰਮ ਕਰਦੀ ਹੈ ਫਿਰ ਉਹ ਜਾ ਕੇ ਪਹੁੰਚਦੀ ਹੈ ਇਸ ਨੂੰ ਕਿੰਨੀ ਉਹਨੂੰ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਵਾਪਸੀ ਆਉਣ ਲੱਗਿਆਂ ਇਸ ਤਰ੍ਹਾਂ ਛੁੱਟੀ ਵੇਲੇ ਫਿਰ ਪਹਿਲਾਂ ਉਹ ਪੈਦਲ ਚਲਦੀ ਹੈ ਫਿਰ ਉਹ ਟੈਕਸੀ ਲੈਣੀ ਬਸ ਲੈਣੀ ਹੈ ਫਿਰ ਕਿਤੇ ਘਰ ਆਉਣਾ ਘਰ ਆ ਕੇ ਫਿਰ ਉਹਨੇ ਆਪਣਾ ਰੋਟੀ ਪਾਣੀ ਬਣਾਉਣੀ ਹੈ ਅਤੇ ਉਹਨੂੰ ਹਰ ਕਦਮ 'ਤੇ ਉਹਨੂੰ ਚੁਣੌਤੀ ਦਾ ਸਾਹਮਣਾ ਕਰਨਾ ਪੈਂਦਾ ਭਾਰਤ ਵਿੱਚ ਹਾਲੇ ਔਰਤ ਸੁਰੱਖਿਅਤ ਨਹੀਂ ਨਹੀਂ ਸੁਰਕਸ਼ਿਤ ਨਹੀਂ ਹੈਗੀ ਜਿਸ ਤਰ੍ਹਾਂ ਪਿੱਛੇ ਦਿੱਲੀ ਵਿੱਚ ਕਿੰਨਾ ਵੱਡਾ ਉਹ ਕਾਂਡ ਹੋਇਆ ਸੀ ਲੜਕੀ ਨਾਲ ਰੇਪ ਹੋਇਆ ਅਤੇ ਉਹ ਨਾਲ ਟਰੈਸਟਡੀ ਹੋ ਗਈ ਕਿੰਨੀ ਸਾਰਾ ਦੇਸ਼ ਨੂੰ ਪਤਾ ਇਸ ਗੱਲ ਦਾ ਹਾਲੇ ਵੀ ਸੁਰ ਔਰਤਾਂ ਦੀ ਸੁਰੱਖਿਆ ਵਾਸਤੇ ਸਾਨੂੰ ਹਰ ਕਿਸੇ ਨਾਗਰਿਕ ਦਾ ਵੀ ਫਰਜ਼ ਬਣਦਾ ਹੈ ਨਾਗਰਿਕ ਹਰ ਇੱਕ ਬੰਦੇ ਦਾ ਫਰਜ਼ ਬਣਦਾ ਹੈ ਕਿ ਔਰਤਾਂ ਨਾਲ ਔਰ ਇੱਜਤ ਨਾਲ ਪੇਸ਼ ਆਓ ਉਹਦੀ ਉਹਦੀ ਸੁਰਕਸ਼ਾ ਨੂੰ ਪਹਿਲੇ ਅਹਿਮੀਅਤ ਦਿੱਤੀ ਜਾਵੇ ਭੈਣ ਭਰਾਵਾਂ ਹਰ ਇੱਕ ਦਾ ਸਾਡਾ ਫਰਜ਼ ਬਣਦਾ ਅਤੇ ਬੱਚਿਆਂ ਨੂੰ ਔਰਤਾਂ ਨੂੰ ਪੜ੍ਹਾ ਕੇ ਅੱਛੀ ਸ਼ਿਕਸ਼ਾ ਵੀ ਦੇਣੀ ਚਾਹੀਦੀ ਹੈ ਅੱਛੀ ਸ਼ਿਕਸ਼ਾ ਨਾਲ ਸਮਾਜ ਵੀ ਅੱਛਾ ਬਣੇਗਾ ਅਤੇ ਔਰਤਾਂ ਦੀ ਵੀ ਸੁਰਕਸ਼ਾ ਵੱਲ ਹਰ ਕੋਈ ਧਿਆਨ ਦੇਵੇਗਾ ਇਸ ਤਰ੍ਹਾਂ ਫਿਰ ਔਰਤਾਂ ਆਪਣੇ ਆਪ ਨੂੰ ਮਹਿਫੂਜ ਸੇਫ ਮਹਿਸੂਸ ਕਰ ਸਕਦੀਆਂ ਹਨ ਅਗਰ ਅੱਛਾ ਸਮਾਜ ਹੋਵੇਗਾ ਤਾਂ ਅੱਛਾ ਹੀ ਸ ਸਭ ਕਿਤੇ ਅੱਛਾ ਹੀ ਹੋਵੇ ਮਿਹਰਬਾਨੀ